ਅਠਾਰਾਂ ਮਾਰਚ ਉੱਨੀ ਵੀਹ ਉੱਨੀ ਅਗਸਤ ਉੱਨੀ ਸੰਨਤਾਲੀ ਪੰਜ ਅਪ੍ਰੈਲ ਉੱਨੀ ਪੰਝੱਤਰ ਛੇ ਜੂਨ ਵੀਹ ਗਿਆਰਾਂ ਸੱਤ ਨਵੰਬਰ ਵੀਹ ਵੀਹ